ਅਠਾਰ੍ਹਾਂ ਅਗਸਤ ਦੋ ਹਜ਼ਾਰ ਬਾਈ ਸਤਾਈ ਮਈ ਦੋ ਹਜ਼ਾਰ ਚੌਦਾਂ ਦਸ ਮਾਰਚ ਦੋ ਹਜਾਰ ਵੀਹ ਪੰਜ ਨਵੰਬਰ ਦੋ ਹਜ਼ਾਰ ਉੱਨੀ ਚਾਰ ਫਰਵਰੀ ਦੋ ਹਰ ਬਾਰ੍ਹਾਂ